ਚੰਗੀ ਗੁਣਵੱਤਾ ਨਸਲ ਵਾਲੇ ਜਿਵੇਂ ਕਿ ਕੁੱਤੇ ਹੋ ਗਏ ਲੈਬਰਾ ਕੁੱਤਾ ਹੋ ਗਿਆ ਪਿਟਬੁੱਲ ਕੁੱਤਾ ਹੋ ਗਿਆ ਜਰਮਨ ਸ਼ੈਫਰਡ ਕੁੱਤਾ ਹੋ ਗਿਆ ਤਾਂ ਇਹ ਕੁੱਤਿਆਂ ਦੀ ਆਪਾਂ ਨੇ ਬਣਤਰ ਅਤੇ ਦੇਖਣਾ ਵੀ ਇਨ੍ਹਾਂ ਦਾ ਕਿੱਦਾਂ ਸਾਹ ਕਿੱਦਾਂ ਫੁੱਲਦਾ ਵੀ ਕੁੱਤੇ ਦੀ ਹਾਈਟ ਅਤੇ ਵਗੈਰਾ ਪਤਾ ਕਰਨਾ ਵੀ ਕੁੱਤਾ ਵਧੀਆ ਹੈਗਾ ਜਾਂ ਨਹੀਂ ਹੈਗਾ ਕੁੱਤਾ ਬੈਠਣ ਉੱਠਣ ਲੱਗੇ ਦੇਖਣਾ ਵੀ ਕਿੱਦਾਂ ਬੈਠਦਾ ਕਿੱਦਾਂ ਨਹੀਂ ਤਾਂ ਸਹੀ ਹੈ ਅਤੇ ਅੱਗੇ ਘੋੜਿਆਂ ਲਗਾ ਲਉ ਜਿੱਕਣਾਂ ਜਿਪਸੀ ਕ ਬੈਨਰ ਘੋੜਾ ਹੋ ਗਿਆ ਅਰਬੀਆ ਘੋੜਾ ਹੋ ਗਿਆ ਅਤੇ ਇਹਦੀ ਬਣਤਰ ਅਤੇ ਇਨ੍ਹਾਂ ਦੇ ਮਸਲਾਂ ਅਤੇ ਇਨ੍ਹਾਂ ਦੀਆਂ ਲੱਤਾਂ 'ਤੇ ਦੇਖਣਾ ਵੀ ਵਜ਼ਨ ਆਉਂਦਾ ਜਾਂ ਨਹੀਂ ਆਉਂਦਾ ਇਸ ਤਰੀਕੇ ਦੇ ਨਾਲ ਜਾਨਵਰ ਚੈੱਕ ਹੁੰਦੇ ਹਨ